ਮੈਨੂੰ ਨਮਾਜ਼ ਪੜ੍ਹ ਕੇ ਬਹੁਤ ਖੁਸ਼ੀ ਮਿਲਦੀ ਹੈ ਰੱਬ ਨੂੰ ਯਾਦ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਨਮਾਜ਼ ਪੜ੍ਹਨਾ ਬਹੁਤ ਪਸੰਦ ਹੈ ਕਿਉਂਕਿ ਇਹ ਨਮਾਜ਼ ਨਾਲ ਦਿਲ ਨੂੰ ਸਕੂਨ ਮਿਲਦਾ ਹੈ ਇਹ ਪੰਜ ਟਾਈਮ ਦਾ ਹੁੰਦਾ ਹੈ ਇੱਕ ਸੁਬਹ ਦੁਪਹਿਰ ਸ਼ਾਮ ਅਤੇ ਰਾਤ ਨੂੰ ਨਮਾਜ਼ ਨਾਲ ਸਾਡੀ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਅਤੇ ਸਨ ਦੇ ਸਰੀਰ ਵਿੱਚ ਤਨਾਓ ਵੀ ਕਮ ਹੁੰਦੇ ਨੇ ਨਮਾਜ਼ ਪੜ੍ਹਨ ਨਾਲ ਸਾਡੀ ਮਾਨਸਿਕ ਸੰਤੁਸ਼ਟੀ ਰਹਿੰਦੀ ਹੈ ਅਤੇ ਕਿਸੇ ਚੀਜ਼ ਦੀ ਟੈਂਸ਼ਨ ਵੀ ਨਹੀਂ ਰੇ ਹੁੰਦਾ ਨਮਾਜ਼ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਨਮਾਜ਼ ਨਾਲ ਅਸੀਂ ਹਰ ਕੰਮ ਸੋਚ ਸਮਝ ਕੇ ਕਰਦੇ ਹਨ ਨਮਾਜ਼ ਸਾਨੂੰ ਹਰ ਸਸ ਨਮਾਜ਼ ਸਾਨੂੰ ਰੱਬ ਦਾ ਤੋਹਫ਼ਾ ਮਿਲਿਆ ਹੈ ਜੋ ਅਸੀਂ ਰੱਬ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਨਮਾਜ਼ ਵਰਗੇ ਤੋਹਫ਼ਾ ਸਾਨੂੰ ਦਿੱਤਾ ਕਿ ਅਸੀਂ ਉਹਨਾਂ ਨੂੰ ਪੜ੍ਹ ਕੇ ਰੱਬ ਨੂੰ ਯਾਦ ਕਰਕੇ ਹਰ ਉਹ ਕੰਮ ਹਾਸਿਲ ਕਰ ਸਕਦੇ ਨੇ ਜੋ ਅਸੀਂ ਰੱਬ ਤੋਂ ਮੰਗਦੇ ਹਨ ਨਮਾਜ਼ ਵਿੱਚ ਬਹੁਤ ਸਕੂਨ ਹੁੰਦਾ ਹੈ ਇਹ ਹਰ ਕੋਈ ਕਰ ਸਕਦਾ ਹੈ ਅਤੇ ਹਰ ਕੋਈ ਰੱਬ ਨੂੰ ਯਾਦ ਕਰਕੇ ਯਾਦ ਕਰਨ ਲਈ ਨਮਾਜ਼ ਨੂੰ ਪੜ੍ਹ ਸਕਦਾ ਹੈ